ਜਦੋਂ ਅਸੀਂ ਪਹਿਲੀ ਵਾਰ ਜ਼ਿੰਦਗੀ ਵਿੱਚ ਚਿੱਤਰਕਾਰੀ ਕਰਦੇ ਹਾਂ ਤਾਂ ਸਾਡੇ ਤੋਂ ਬਹੁਤ ਕਲ ਬਹੁਤ ਜ਼ਿਆਦਾ ਗਲਤੀਆਂ ਹੋ ਜਾਂਦੀਆਂ ਹਨ ਜਿਵੇਂ ਕਿ ਕਈ ਵਾਰ ਤਾਂ ਪੇਜ ਉੱਪਰ ਕਲਰ ਗਿਰ ਜਾਂਦਾ ਹੈ ਕਈ ਵਾਰ ਤਾਂ ਫੋਟੋ ਹੀ ਟੇਢੀ ਹੋ ਜਾਂਦੀ ਹੈ ਕਈ ਵਾਰ ਜਿਵੇਂ ਕਿ ਕੋਈ ਚਿੱਤਰਕਾਰੀ ਕਰਦੇ ਹਾਂ ਤਾਂ ਕਿਸੇ ਵੀ ਚੀਜ਼ ਦਾ ਹੱਥ ਪੈਰ ਉਲਟ ਹੋ ਜਾਂਦਾ ਹੈ ਅਤੇ ਕਈ ਵਾਰ ਤਾਂ ਸਾਡੇ ਤੋਂ ਪੇਜ ਹੀ ਟੇਢਾ ਹੋ ਜਾਂਦਾ ਹੈ ਇਸ ਲਈ ਸਾਨੂੰ ਵਧੀਆ ਚਿੱਤਰਕਾਰੀ ਕਰਨ ਲਈ ਵਧੀਆ ਚਿੱਤਰਕਾਰ ਦੀ ਲੋੜ ਹੈ ਇਸ ਲਈ ਅਸੀਂ ਉਸ ਤੋਂ ਵਧੀਆ ਕਲਾਕਾਰ ਬਣ ਸਕਦੇ ਹਾਂ ਵਧੀਆ ਕਲਾਕਾਰੀ ਬਣਾਉਣ ਲਈ ਸਾਨੂੰ ਵਧੀਆ ਸਾਫ ਪੇਜ ਦੀ ਲੋੜ ਹੈ ਵਧੀਆ ਕਲਰ ਦੀ ਲੋੜ ਹੈ ਅਤੇ ਵਧੀਆ ਕਲਾਕਾਰੀ ਆਉਣੀ ਵੀ ਬਹੁਤ ਜ਼ਰੂਰੀ ਹੈ ਇਸ ਲਈ ਅਸੀਂ ਪੇਂਟ ਕਰਨਾ ਸਕੈਚਿੰਗ ਕਰਨੀ ਸਾਨੂੰ ਬਹੁਤ ਚੰਗੇ ਤਰੀਕੇ ਨਾਲ ਆਉਣੀ ਚਾਹੀਦੀ ਹੈ ਇਸ ਲਈ ਕਲਾਕਾਰ ਬਣਨਾ ਬਹੁਤ ਸੌਖਾ ਨਹੀਂ ਇਸ ਲਈ ਚਿੱਤਰਕਾਰੀ ਕਰਨੀ ਬਹੁਤ ਔਖੀ ਹੈ ਇਸ ਲਈ ਅਸੀਂ ਚਿੱਤਰਕਾਰ